ਬੇਸ਼ੱਕ ਮਤਲਬ ਬ੍ਰਹਮਾਂਡ ਤਾਂ ਕਾਫੀ ਵੱਡੀ ਚੀਜ਼ ਆ ਅਸੀਂ ਤਾਂ ਇੱਕ ਪ੍ਰਿਥਵੀ ਛੋਟਾ ਜਿਹਾ ਤਿਨਕਾ ਏ ਬ੍ਰਹਮਾਂਡ ਦੇ ਵਿੱਚ ਅਤੇ ਜ਼ਾਹਿਰ ਹੈ ਕਿ ਸਾਨੂੰ ਇਹਨਾਂ ਇਹਨਾਂ ਚੀਜ਼ਾਂ ਦਾ ਇੱਕ ਮਤਲਬ ਕਾਫੀ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈਗਾ ਅਤੇ ਗੱਲ ਕੀਤੀ ਜਾਵੇ ਕੁਝ ਅਨਸੁਲਝੀਆਂ ਚੀਜ਼ਾਂ ਅਤੇ ਹਾਂਜੀ ਕਾਫੀ ਅਨਸੁਲਝੀਆਂ ਚੀਜ਼ਾਂ ਹਜੇ ਵੀ ਹੈਗੀਆਂ ਜਿੱਦਾਂ ਐਜਿਪਟ ਅਜਿਪਟ ਦੀ ਹੁ ਅਜਿਪਟ ਦੇ ਪਿਰਾਮਿਡਸ ਹੋ ਗਏ ਤੇ ਫਿਰ ਏਲੀਅਨ ਥਿਓਰੀ ਹੋ ਗਈ ਬਲੈਕ ਹੋਲ ਹੋ ਗਿਆ ਅਤੇ ਫਿਰ ਆਪਣੀ ਜਿਹੜੇ ਸੋਲਰ ਸਿਸਟਮ ਕਿੱਦਾਂ ਬਣਿਆ ਅਤੇ ਇਹ ਹੋਰ ਵੀ ਚੀਜ਼ਾਂ ਨੇ ਜਿੱਦਾਂ ਮਲਟੀਵਰਸ ਹੋ ਗਿਆ ਫੋਰ ਡਾਇਮੈਂਸ਼ਨ ਹੋ ਗਿਆ ਸਪੀਡ ਆਫ ਲਾਈਟ ਹੋ ਗਈ ਬਲੈਕ ਹੋਲ ਹੋ ਗਿਆ ਟਾਈਮ ਟਰੈਵਲ ਹੋ ਗਿਆ ਕਾਫੀ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਅਜੇ ਅਨਸੁਲਝੀਆਂ ਹੋਈਆਂ ਅਤੇ ਸਾਇੰਟਿਸਟ ਇਹਨਾਂ ਵੱਖ ਵੱਖ ਦੇਸ਼ ਦੇ ਲੱਗੇ ਹੋਏ ਨੇ ਇਹਨਾਂ ਚੀਜ਼ਾਂ ਨੂੰ ਸੁਲਝਾਉਣ ਵਿੱਚ ਅਤੇ ਕਾਫੀ ਜ਼ਾਹਿਰ ਹੈ ਕਿ ਮਤਲਬ ਕਾਫੀ ਟਾਈਮ ਲੱਗੇਗਾ ਅਜੇ ਇਹਨਾਂ ਚੀਜ਼ਾਂ ਨੂੰ ਸੋਲਵ ਕਰਨ ਵਿੱਚ ਕਿਉਂਕਿ ਇਹ ਚੀਜ਼ਾਂ ਕਾਫੀ ਆਪਣੀ ਸੋਚ ਤੋਂ ਪਰੇ ਆ ਅਤੇ ਕਾਫੀ ਡਿਫੀਕਲਟ ਹੁੰਦਾ ਇਹਨਾਂ ਚੀਜ਼ਾਂ 'ਤੇ ਰਿਸਰਚ ਕਰਨੀ ਸਟਡੀ ਕਰਨੀ ਅਤੇ